ਹੈਲੋ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਤੁਸੀਂ ਸਵਿਗੀ ਤੋਂ ਬੋਲਦੇ ਜੇ ਹਾਂਜੀ ਸਾਡੇ ਨਾ ਘਰ ਪ੍ਰੋਗਰਾਮ ਸੀਗਾ ਪਾਠ ਹੈਗਾ ਸੁਖਮਨੀ ਸਾਹਿਬ ਦਾ ਅਤੇ ਥੋੜ੍ਹੇ ਜਿਹੇ ਮਹਿਮਾਨ ਆਉਣੇ ਆ ਉਹਨਾਂ ਲਈ ਰੋਟੀ ਦਾ ਪ੍ਰਬੰਧ ਕਰਨਾ ਅਤੇ ਉਹ ਔਡਰ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਸੀਗੇ ਮੰਗਵਾਉਣਾ ਔਡਰ ਸਾਨੂੰ ਚਾਹੀਦਾ ਜੇ ਬ੍ਰਦਰ ਢਾਬੇ ਤੋਂ ਆਹ ਜਿਹੜਾ ਇੱਧਰ ਨਹੀਂ ਹੈਗਾ ਕੋਤਵਾਲੀ ਲਾਗੇ ਬ੍ਰਦਰ ਢਾਬਾ ਉਹ ਉੱਧਰ ਦਾ ਸਾਨੂੰ ਚਾਹੀਦਾ ਸਮਾਨ ਅਤੇ ਉਹ ਤੁਸੀਂ ਸਮਾਨ ਜਰਾ ਨੋਟ ਕਰ ਲਓ ਦਸ ਪਨੀਰ ਟਿੱਕਾ ਪੰਜ ਦਾਲ ਮੱਖਣੀ ਛੇ ਮਿਕਸ ਵੈੱਜ ਦਸ ਬਟਰ ਨਾਨ ਪੰਦਰਾਂ ਲੱਛਾ ਪਰੌਂਠਾ ਅਤੇ ਪੰਜ ਗਾਰਲਿਕ ਨਾਨ ਅਤੇ ਭਾਅ ਜੀ ਮਿੱਠੇ ਵਿੱਚ ਨੋਟ ਕਰ ਲਓ ਚਾਲੀ ਗੁਲਾਬ ਜਾਮਣ ਪੱਚੀ ਰਸ ਮਲਾਈ ਦਸ ਪਲੇਟਾਂ ਗਜਰੇਲਾ ਸਮਾਨ ਪਹੁੰਚਾਉਣ ਲਈ ਭਾਅ ਜੀ ਐਡਰੈਸ ਨੋਟ ਕਰੋ ਹਾਊਸ ਨੰਬਰ ਚੌਂਤੀ ਕੋਟ ਰਲਿਆ ਰਾਮ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਹਾਂਜੀ ਭਾਅ ਜੀ ਇਹ ਜਿਹੜਾ ਮੇਰਾ ਫੋਨ ਨੰਬਰ ਇਹ ਵੀ ਤੁਸੀਂ ਸੇਵ ਕਰ ਲਓ ਅਤੇ ਔਡਰ ਜਿਹੜਾ ਉਹ ਦੋ ਢਾਈ ਵਜੇ ਦੇ ਤੱਕ ਜਿਹੜਾ ਉਹ ਸਾਡੇ ਤੱਕ ਪਹੁੰਚ ਜਾਣਾ ਚਾਹੀਦਾ ਵਾ ਜ਼ਿਆਦਾ ਲੇਟ ਨਾ ਹੋਵੇ ਫਿਰ ਮੁਸ਼ਕਿਲ ਹੋ ਜਾਵੇਗੀ ਸਾਨੂੰ ਅਤੇ ਇਹ ਸਾਡਾ ਔਡਰ ਵੱਡਾ ਵਾ ਸਾਨੂੰ ਕੋਈ ਛੂਟ ਕੂਪਨ ਜਾਂ ਪ੍ਰੋਮੋ ਕੋਡ ਜਿਹੜੇ ਹੈਗੇ ਆ ਛੂਟ ਕੂਪਨ ਦੇ ਉਹ ਸਾਨੂੰ ਅਵੇਲੇਬਲ ਕਰਵਾਓ ਅਤੇ ਔਡਰ ਜਿਹੜਾ ਉਹ ਟਾਈਮ ਸਿਰ ਭਾਅ ਜੀ ਮਿਲ ਜਾਣਾ ਚਾਹੀਦਾ ਧੰਨਵਾਦ